ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਮੈਂ ਨਾ ਜੀ ਟਿਕਟ ਪੋਸਟਪੋਨ ਕਰਵਾਉਣੀ ਸੀਗੀ ਆਪਣੀ ਅਤੇ ਤੁਸੀਂ ਦੱਸ ਸਕਦੇ ਹੋ ਪੋਸਟਪੋਨ ਹੋ ਸਕਦੀ ਟਿਕਟ ਮੈਡਮ ਘਰ ਨਾ ਜੀ ਥੋੜ੍ਹਾ ਡੈਥ ਹੋ ਗਈ ਸੀਗੀ ਜੀ ਅਤੇ ਉਹ ਫਿਰ ਤਾਂ ਕਰਕੇ ਜੀ ਫਾਦਰ ਸਾਹਿਬ ਦੀ ਅਤੇ ਫਿਰ ਤਾਂ ਮੈਂ ਸਫਰ ਕਰ ਨਹੀਂ ਪਾਉਂਗੀ ਇਸ ਲਈ ਮੈਂ ਕੈਨ ਪੋਸਟਪੋਨ ਕਰਵਾਉਣੀ ਸੀ ਜੀ ਇਹ ਥੋੜ੍ਹਾ ਪਿੱਛੇ ਹੋ ਜਾਵੇ ਜੇ ਅੱਛਾ ਜੀ ਮੈਡਮ ਅਤੇ ਫਿਰ ਜੇ ਆਪਾਂ ਹੁਣ ਕੈਂਸਲ ਕਰਵਾਉਂਦੇ ਹਾਂ ਤਾਂ ਪੈਸੇ ਪੂਸੇ ਕੱਟੇ ਜਾਣਗੇ ਇਹਦੇ ਵਿੱਚ ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਮੈਡਮ ਤੁਸੀਂ ਨਹੀਂ ਜੀ ਤਤ ਤਤ ਤਤਕਾਲ ਦੇ ਵਿੱਚ ਤਾਂ ਨਹੀਂ ਹੈਗੀ ਮੈਡਮ ਜੀ ਅਤੇ ਤੁਸੀਂ ਸਤਾਰਾਂ ਤਰੀਕ ਦੀ ਟਿਕਟ ਦੱਸ ਦੋਂਗੇ ਵੇਖ ਕੇ ਹੋ ਜਾਵੇਗੀ ਫਰੀਦਕੋਟ ਤੋਂ ਦਿੱਲੀ ਮੈਡਮ ਤੁਸੀਂ ਸਲੀਪਰ 'ਚ ਹੀ ਕਰਾ ਦਿਓ ਜੀ

ਹਾਂਜੀ ਹਾਂਜੀ ਵੇਟਿੰਗ ਹੈਗੀ ਹੈ ਜੀ ਅਤੇ ਫਿਰ ਤਤਕਾਲ ਦੇ ਵਿੱਚ ਜੇ ਕਰਵਾਉਂਦੇ ਹਾਂ ਆਪਾਂ ਅਤੇ ਫਿਰ ਉਹਦਾ ਕਿਵੇਂ ਹੁੰਦਾ ਗਾ ਹਾਂਜੀ ਉਦੋਂ ਹੀ ਕਰਾਉਣੀ ਪੈਂਦੀ ਹੈ ਜੀ ਤਤਕਾਲ 'ਚ ਅੱਛਾ ਜੀ ਅੱਛਾ ਜੀ ਕਨਫਰਮ ਹੋ ਜੂਗੀ ਠੀਕ ਹੈ ਜੀ ਠੀਕ ਹੈ ਅਤੇ ਕੋਈ ਹੋਰ ਟ੍ਰੇਨ ਦਾ ਦੱਸ ਸਕਦੇ ਹੋ ਹੋਰ ਕਿਹੜੀ ਕਿਹੜੀ ਟ੍ਰੇਨ ਜਾਂਦੀ ਹੈ ਜੀ ਫਰੀਦਕੋਟ ਤੋਂ ਅੱਛਾ ਅਤੇ ਸੁਬਾਹ ਕਿੰਨੇ ਵਿੱਚ ਪਹੁੰਚ ਜਾਂਦੇ ਹਾਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਅਤੇ ਇਹਦੇ ਵਿੱਚ ਵੇਟਿੰਗ ਚੱਲ ਰਹੀ ਹੈ ਤੁਸੀਂ ਇੱਕ ਵਾਰੀ ਇਹਦੇ ਵਿੱਚ ਵੀ ਵੇਖ ਕੇ ਦੱਸ ਦਿਓ ਮੈਨੂੰ ਜੇ ਹੈਗੀ ਹੈ ਤਾਂ ਸਤਾਰਾਂ ਤਾਰੀਕ ਦੀ ਹਾਂਜੀ ਠੀਕ ਹੈ ਜੀ ਅਤੇ ਜੇ ਹੁਣ ਕਰੀਏ ਤਾਂ ਕਨਫਰਮ ਹੋ ਜੂਗੀ ਹੈ ਤਾਂ ਸਤਾਰਾਂ ਨੂੰ ਹਾਂਜੀ ਅਤੇ ਪਲੀਜ਼ ਠੀਕ ਹੈ ਜੀ ਠੀਕ ਹੈ ਜੀ ਅਤੇ ਚੱਲੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜਾਣਕਾਰੀ ਵਾਸਤੇ